ਅੱਜ ਦੇ ਸਮੇਂ ਦੇ ਵਿੱਚ ਕੱਪੜੇ ਹੱਥਾਂ ਨਾਲ਼ ਧੋਣਾ ਕੋਈ ਪਸੰਦ ਨਹੀਂ ਕਰਦਾ ਹੈ ਕਿਉਂਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਇਹੋ ਜਿਹੀ ਮਸ਼ੀਨਾਂ ਆ ਗਈਆਂ ਹਨ ਕਿ ਜਿਹਦੇ ਵਿੱਚ ਕੱਪੜੇ ਨਾਲ਼ ਦੀ ਨਾਲ਼ ਧੋ ਹੋ ਜਾਂਦੇ ਹਨ ਅਤੇ ਨਾਲ਼ ਦੀ ਨਾਲ਼ ਸੁੱਕ ਜਾਂਦੇ ਹਨ ਪਰ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣੇ ਹੱਥਾਂ ਨਾਲ਼ ਧੋ ਕੇ ਅਤੇ ਤਾਰਾਂ 'ਤੇ ਉੱਪਰ ਸੁੱਕਣੇ ਪਾਉਂਦਾ ਹਨ ਅਤੇ ਜੇਕਰ ਤੇਜ਼ ਹਵਾ ਚੱਲੇ ਤਾਂ ਮੈਂ ਅਸੀਂ ਉਹਦੇ ਉੱਪਰ ਸਟਿੱਕਣੀਆਂ ਲਾ ਦਿੰਦੇ ਹਨ ਪਰ ਅੱਜ ਕੱਲ੍ਹ ਕੱਪੜੇ ਸੁੱਕਣ ਦੀ ਵੀ ਅਲੱਗ ਅਲੱਗ ਵਿਧੀਆਂ ਹੁੰਦੀ ਹਨ ਅਤੇ ਕੋਈ ਮਸ਼ੀਨਾਂ ਦੇ ਵਿੱਚ ਸੁਕਾਉਂਦਾ ਹੈ ਪਰ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਕੱਪੜੇ ਪੁੱਠੇ ਉਹ ਪੁੱਠੇ ਕਰਕੇ ਧੁੱਪ ਦੇ ਵਿੱਚ ਸੁੱਕਣੇ ਪਾ ਦਿੰਦਾ ਹਨ ਅਤੇ ਜਿਸ ਕਾਰਨ ਮਤਲਬ ਕੱਪੜੇ ਛੇਤੀ ਸੁੱਕ ਜਾਂਦੇ ਹਨ